ਮੇਰਾ ਨਾਮ ਭੂਮਿਕਾ ਸ਼ਰਮਾ ਹੈ ਅਤੇ ਮੈਂ ਸਨਾਤਨ ਧਰਮ ਨਾਲ ਜੁੜੀ ਹੋਈ ਹਾਂ ਜਿਸ ਨੂੰ ਹਿੰਦੂ ਧਰਮ ਵੀ ਕਿਹਾ ਜਾਂਦਾ ਹੈ ਸਾਡੇ ਸਕੂਲਾਂ ਵਿੱਚ ਇਸ ਧਰਮ ਬਾਰੇ ਐਨਾ ਕੋਈ ਖਾਸ ਪਾਠਕ੍ਰਮ ਨਹੀਂ ਹੈ ਪਰ ਮੈਂ ਚਾਹੁੰਦੀ ਹਾਂ ਕਿ ਇਸ ਵਿੱਚ ਬਦਲਾਵ ਆਏ ਸਕੂਲਾਂ ਵਿੱਚ ਸਨਾਤਨ ਧਰਮ ਬਾਰੇ ਗਿਆਨ ਦਿੱਤਾ ਜਾਵੇ ਤਾਂ ਕਿ ਜੋ ਸਮਾਜ ਦੀ ਅੱਜ ਸਨਾਤਨ ਧਰਮ ਬਾਰੇ ਸੋਚ ਹੈ ਉਹ ਬਦਲੀ ਜਾ ਸਕੇ ਅੱਜ ਦੇ ਯੁੱਗ ਵਿੱਚ ਸਨਾਤਨ ਧਰਮ ਦੇ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਗਿਆਨ ਨਹੀਂ ਹੈ ਜਿਸ ਨਾਲ ਸਮਾਜ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਸੈਕੁਲਰਰਿਜ਼ਮ ਵਰਡ ਡ ਨੂੰ ਐਨਾ ਜ਼ਿਆਦਾ ਵਧਾ ਚੜਾ ਕੇ ਸਕੂਲਾਂ ਵਿੱਚ ਸਿਖਾ ਦਿੱਤਾ ਗਿਆ ਹੈ ਕਿ ਲੋਕ ਇਸ ਦੀ ਸਹੀ ਵਰਤੋਂ ਨਹੀਂ ਕਰ ਰਹੇ ਉਹ ਗਲਤ ਧਰਮਾਂ ਨੂੰ ਅੱਗੇ ਲਿਆ ਕੇ ਧਰਮ ਅਤੇ ਜਾਤ ਪਾਤ ਬਾਰੇ ਲੜ ਰਹੇ ਹਨ ਅਤੇ ਇਸ ਦੇ ਨਾਲ ਨਾਲ ਗਲਤ ਕੰਮ ਕਰ ਰਹੇ ਹਨ ਜਦਕਿ ਜੇ ਸਨਾਤਨ ਧਰਮ ਬਾਰੇ ਦੱਸਿਆ ਜਾਵੇ ਤਾਂ ਇਹ ਸਭ ਬਦਲਿਆ ਜਾ ਸਕਦਾ ਹੈ ਸਨਾਤਨ ਧਰਮ ਹੀ ਹੈ ਜੋ ਇਸ ਬਦਲਾਵ ਨੂੰ ਪੂਰਾ ਕਰ ਸਕਦਾ ਹੈ